ਮੇਰਾ ਆਧਾਰ ਕਾਰਡ ਗੁੰਮ ਹੋ ਗਿਆ ਸੀ ਉਸ ਨੂੰ ਲੱਭਣ ਦੇ ਲਈ ਮੇਰੇ ਭਰਾ ਨੇ ਮੈਨੂੰ ਕੁਝ ਇਸ ਤਰ੍ਹਾਂ ਦੇ ਸਟੈਪ ਦੱਸੇ ਪਹਿਲਾਂ ਆਧਾਰ ਦੀ ਜਾਂਚ ਕਰੋ ਸਭ ਤੋਂ ਪਹਿਲਾਂ ਆਧਾਰ ਕਾਰਡ ਦੇ ਨੰਬਰ ਜਾਂ ਰਜਿਸਟਰੇਸ਼ਨ ਨੰਬਰ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਇਹ ਮਿਲ ਜਾਂਦਾ ਹੈ ਤਾਂ ਤੁਸੀਂ ਆਧਾਰ ਦੀ ਸਰਵਿਸ ਦੀ ਵਰਤੋਂ ਕਰ ਸਕਦੇ ਹੋ ਆਧਾਰ ਪੋਟਰਲ 'ਤੇ ਜਾਓ ਯੂਨੀਕ ਆਈਡੈਂਟੀਫਿਕੇਸ਼ਨ ਅਥੋਰਟੀ ਇੰਡੀਆ ਦੀ ਵੈਬਸਾਈਟ 'ਤੇ ਜਾਓ ਤੀਸਰਾ ਗੁੰਮ ਹੋਏ ਆਧਾਰ ਕਾਰਡ ਦੀ ਰੀਕਵਰੀ ਵੈਬਸਾਈਟ 'ਤੇ ਡਾਊਨਲੋਡ ਆਧਾਰ ਵਿਕਲਪ ਚੁਣੋ ਆਪਣੇ ਰਜਿਸਟਰ ਕੀਤੇ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਨਾਲ ਓਟੀਪੀ ਪ੍ਰਾਪਤ ਕਰੋ ਓਟੀਪੀ ਦਰਜ ਕਰੋ ਅਤੇ ਤੁਹਾਡਾ ਆਧਾਰ ਡਾਊਨਲੋਡ ਕਰੋ ਚੌਥਾ ਆਧਾਰ ਰਜਿਸਟਰੇਸ਼ਨ ਸੰਕੇ ਜੇ ਤੁਹਾਨੂੰ ਆਪਣੇ ਆਧਾਰ ਕਾਰਡ ਦੀ ਰਿਕਵਰੀ ਨਹੀਂ ਮਿਲਦੀ ਤਾਂ ਤੁਸੀਂ ਨਜ਼ਦੀਕੀ ਆਧਾਰ ਕੇਂਦਰ 'ਤੇ ਜਾ ਕੇ ਨਵਾਂ ਆਧਾਰ ਕਾਰਡ ਜਨਰੇਟ ਕਰਵਾ ਸਕਦੇ ਹੋ ਐਫ ਆਈ ਆਰ ਦਰਜ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਧਾਰ ਕਾਰਡ ਦੇ ਗੁੰਮ ਹੋਣ ਨਾਲ ਤੁਹਾਡੀ ਪਛਾਣ ਸੁਰੱਖਿਆ ਨੂੰ ਖਤਰਾ ਹੈ ਤਾਂ ਤੁਸੀਂ ਪੁਲਿਸ ਸਟੇਸ਼ ਸਟੇਸ਼ਨ 'ਤੇ ਐਫ ਆਈ ਆਰ ਦਰਜ ਕਰ ਸਕਦੇ ਹੋ ਛੇਵਾਂ ਨਵੇਂ ਆਧਾਰ ਕਾਰਡ ਦੇ ਲਈ ਅਰਜ਼ੀ ਜੇ ਤੁਸੀਂ ਨਵਾਂ ਆਧਾਰ ਕਾਰਡ ਮੰਗਵਾਉਣ ਦਾ ਫੈਸਲਾ ਕਰਦੇ ਹੋ ਤਾਂ ਨਵੀਂ ਐਪਲੀਕੇਸ਼ਨ ਦੇ ਰੂਪ ਵਿੱਚ ਸਾਰੇ ਜ਼ਰੂਰੀ ਦਸਤਾਵੇਜ਼ ਜਾਣਕਾਰੀ ਭਰ ਕੇ ਆਧਾਰ ਕੇਂਦਰ 'ਤੇ ਜਾਓ ਸੁਰੱਖਿਆ ਲਈ ਪ੍ਰਧਾਨ ਕੀਤੇ ਗਏ ਟਿਪਸ ਆਪਣੀ ਆਧਾਰ ਜਾਣਕਾਰੀ ਨੂੰ ਸੁਰੱਖਿਅਤ ਰੱਖੋ ਅਤੇ ਕਿਸ ਨਾਲ ਵੀ ਸਾਂਝਾ ਨਾ ਕਰੋ ਆਧਾਰ ਲਿੰਕਿੰਗ ਅਤੇ ਸਰਵਿਸਿਸ ਦੇ ਜ਼ਰੂਰੀ ਵਿਕਲਪਾਂ ਨੂੰ ਸੰਭਾਲੋ ਅੱਠਵਾਂ ਐਪ ਦੀ ਵਰਤੋਂ ਕਰੋ ਯੂਡੀਆਈ ਦੀ ਮੋਬਾਈਲ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੀ ਆਧਾਰ ਜਾਣਕਾਰੀ ਨੂੰ ਪ੍ਰਬੰਧਿਤ ਕਰ ਸਕਦੇ ਹੋ ਇਹ ਸਾਰੇ ਕਦਮ ਤੁਹਾਨੂੰ ਆਪਣੇ ਗੁੰਮ ਹੋਏ ਆਧਾਰ ਕਾਰਡ ਦੀ ਵਿਕਰੀ ਜਾਂ ਨਵਾਂ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ ਆਧਾਰ ਸੇਵਾ ਕੇਂਦਰ ਜੇ ਤੁਸੀਂ ਅਧਾਰ ਕਾਰਡ ਰਜਿਸਟਰੇਸ਼ਨ ਜਾਂ ਮੋਡੀਫਿਕੇਸ਼ਨ ਲਈ ਜਾ ਰਹੇ ਹੋ ਤਾਂ ਤੁਹਾਨੂੰ ਨਜ਼ਦੀਕੀ ਆਧਾਰ ਕਾਰਡ ਸੇਵਾ ਕੇਂਦਰ 'ਤੇ ਜਾਣ ਦੀ ਲੋੜ ਪਵੇਗੀ